ਪੰ ਮੈਂ ਜ਼ਿਆਦਾ ਕਰਕੇ ਪੰਜਾਬ 'ਚ ਅਜੇ ਘੁੰਮੀ ਹਾਂ ਪੰਜਾਬ ਤੋਂ ਬਾਹਰ ਜਾਣ ਦਾ ਮੇਰਾ ਅਜੇ ਕੋਈ ਪਲੈਨ ਨਹੀਂਂ ਬਣਿਆ ਮੈਂ ਅੰਮ੍ਰਿਤਸਰ ਘੁੰਮੀ ਹਾਂ ਅੰਮ੍ਰਿਤਸਰ ਵਿੱਚ ਜਿਵੇਂ ਕਿ ਗੋਲਡਨ ਟੈਂਪਲ ਉੱਥੇ ਦਾ ਫੇਮਸ ਹੈ ਮੈਂ ਉਹ ਵੇਖਿਆ ਅਤੇ ਉੱਥੋਂ ਦਾ ਬਜ਼ਾਰ ਦੇਖਿਆ ਕਿਉਂਕਿ ਉਹ ਵੀ ਬਹੁਤ ਜ਼ਿਆਦਾ ਵਧੀਆ ਐਵੇਂ ਲੱਗਦਾ ਬਜ਼ਾਰ ਜਾ ਕੇ ਜਿਵੇਂ ਕਿਤੇ ਬਾਹਰ ਆਇਆ ਹੋਵੇ ਹਰੇਕ ਦੁਕਾਨ ਮੀਨਿੰਗ ਬਹੁਤ ਜ਼ਿਆਦਾ ਵਧੀਆ ਸਜਾਵਟ ਕੀਤੀ ਹਰੇਕ ਦੁਕਾਨ ਦੀ ਉਸ ਤੋਂ ਬਾਅਦ ਅਸੀਂ ਉੱਥੋਂ ਦਾ ਜ਼ਲ੍ਹਿਆਂਵਾਲਾ ਬਾਗ ਜੋ ਕਿ ਬਹੁਤ ਜ਼ਿਆਦਾ ਫੇਮਸ ਉਹ ਵੇਖਿਆ ਅਤੇ ਉਸ ਤੋਂ ਉਪਰੰਤ ਅਸੀਂ ਵਾਹਗਾ ਬੋਰਡਰ ਬਾਰੇ ਸੁਣਿਆ ਤਾਂ ਅਸੀਂ ਉਹ ਵੀ ਦੇਖਿਆ ਉਹ ਵੀ ਬਹੁਤ ਵਧੀਆ ਲੱਗਿਆ ਅਤੇ ਜਲੰਧਰ ਵੀ ਮੈਂ ਘੁੰਮੀ ਹਾਂ ਜਲੰਧਰ ਦਾ ਜਿਵੇਂ ਕਿ ਨਕੋਦਰ ਆ ਉੱਥੋਂ ਦੀ ਫੇਮਸ ਸਭ ਤੋਂ ਨਕੋਦਰ ਬਹੁਤ ਵਧੀਆ ਲੱਗਿਆ ਜਾ ਕੇ ਉੱਥੋਂ ਮੀਨਿੰਗ ਕਿ ਉੱਥੇ ਦੀਆਂ ਦਰਗਾਹਾਂ ਵੇਖ ਕੇ ਬਹੁਤ ਜ਼ਿਆਦਾ ਸਕੂਨ ਮਿਲਦਾ ਹੈ ਅਤੇ ਆਪਣਾ ਰਾਜਾ ਸਾਹਿਬ ਵੀ ਹੈਗਾ ਵੈਸੇ ਤਾਂ ਰਾਜਾ ਸਾਹਿਬ ਵੀ ਬਹੁਤ ਚੰਗੀ ਜਗ੍ਹਾ ਹੈ ਉੱਥੇ ਵੀ ਬਹੁਤ ਵਧੀਆ ਸਕੂਨ ਮਿਲਦਾ ਜਾ ਕੇ ਅਤੇ ਹੋਰ ਮੈਂ ਇਨ ਫਿਊਚਰ ਮੈਂ ਸੋਚਾਂਗੀ ਕਿ ਮੈਂ ਹੋਰ ਵੀ ਜਗ੍ਹਾ ਘੁੰਮਣ ਜਾਵਾਂ ਫਿਲਹਾਲ ਕਿਉਂਕਿ ਮੈਂ ਸਟੱਡੀ ਕਰ ਰਹੀ ਹਾਂ ਤਾਂ ਮੇਰਾ ਕੋਈ ਪਲੈਨ ਨਹੀਂ ਬਣਦਾ ਤਾਂ ਜਦੋਂ ਮੈਂ ਸਟੱਡੀ ਕਰ ਲਵਾਂਗੀ ਇਸ ਤੋਂ ਉਪਰੰਤ ਮੈਂ ਕੋਈ ਆਪਣਾ ਪਲੈਨ ਬਣਾ ਕੇ ਬਾਹਰ ਵੀ ਪੰਜਾਬ ਤੋਂ ਬਾਹਰ ਘੁੰਮਣ ਜਾਵਾਂਗੀ